ਸਕੂਲ ਵਿੱਚ ਸਭ ਤੋਂ ਵੱਧ ਮੇਰਾ ਮਨਪਸੰਦ ਵਿਸ਼ਾ ਸੀਗਾ ਪੰਜਾਬੀ ਅਤੇ ਪੰਜਾਬੀ ਵਿਸ਼ਾ ਕਿਉਂਕਿ ਪੰਜਾਬੀ ਮਾਤ ਭਾਸ਼ਾ ਅਤੇ ਪੰਜਾਬੀ ਨਾਲ ਹੀ ਸਾਡਾ ਪਿਆਰ ਹੈ ਅਤੇ ਸੌਖੀ ਹੈ ਅਤੇ ਅੱਗੇ ਵੀ ਜੋ ਸਕੋਪ ਹੈ ਉਸ ਨੂੰ ਲੈ ਕੇ ਮੈਂ ਚੁਣਿਆ ਸੀ ਅਤੇ ਮਨਪਸੰਦ ਵਿਸ਼ਾ ਤਾਂ ਉਹੀ ਹੈ ਅਤੇ ਸਭ ਤੋਂ ਔਖਾ ਮੈਨੂੰ ਲੱਗਦਾ ਮੈਥ ਅਤੇ ਜੋ ਮੈਨੂੰ ਜਮ੍ਹਾਂ ਨਹੀਂ ਸਮਝ ਆਉਂਦਾ ਸੀਗਾ ਅਤੇ ਉਸਦਾ ਪਤਾ ਹੀ ਨਹੀਂ ਲੱਗਦਾ ਸੀਗਾ ਐਕਸ ਵਾਈ ਜ਼ੈੱਡ ਕਿੱਥੋਂ ਆ ਗਿਆ ਕਿਹੜੀ ਥਿਊਰਮ ਕਿਵੇਂ ਹੈ ਤਾਂ ਦਸਵੀਂ ਤੋਂ ਬਾਅਦ ਮੈਂ ਮੈਥ ਕੀਤਾ ਹੀ ਨਹੀਂ ਅਤੇ ਸਕੂਲ ਦੀ ਸਭ ਤੋਂ ਵਧੀਆ ਯਾਦ ਸਾਡੀ ਸੀਗੀ ਯਾਰਾਂ ਦੋਸਤਾਂ ਨਾਲ ਸਕੂਲ ਦੇ ਲੈਕਚਰ ਜੋ ਵੀ ਸੀ ਉਹ ਛੱਡ ਦਿੰਦੇ ਸੀਗੇ ਅਸੀਂ ਬਾਹਰ ਫਿਰੀ ਜਾਣਾ ਸਪੋਰਟਸ ਵੱਲ ਵੱਧ ਧਿਆਨ ਦੇਣਾ ਸਪੋਰਟਸ ਵੱਲ ਹੀ ਧਿਆਨ ਦੇਣਾ ਹੈ ਨਾ ਫਿਰ ਸਪੋਰਟਸ ਦੇ ਲੈਕਚਰ ਵੱਧ ਲਾਈ ਜਾਣੇ ਟੀਚਰਾਂ ਨਾਲ ਬਣੀ ਹੁੰਦੀ ਟੀਚਰ ਕਹਿੰਦੇ ਨਹੀਂ ਸੀਗੇ ਬਸ ਇਹੀ ਨੇ ਯਾਦਾਂ ਕਿ ਯਾਰਾਂ ਦੋਸਤਾਂ ਨਾਲ ਪੰਗੇ ਲੈਣੇ ਖੇਡਣਾ ਵਗੈਰਾ ਬਸ ਇਹੀ ਅਤੇ ਕਿਤੇ ਚਲੇ ਗਏ ਆ ਗਏ ਬਸ ਇਹੀ ਯਾਦਾਂ ਨੇ ਯਾਰਾਂ ਦੋਸਤਾਂ ਨਾਲ ਇਹੀ ਖੁਸ਼ੀ ਹੈ ਸਭ ਤੋਂ ਵੱਧ ਇਹੀ ਯਾਦ ਆਉਂਦੀ ਹੈ ਅਤੇ ਇਹੀ ਪਲ ਯਾਦ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ